ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਬੋਲੋ ਵਧੀਆ ਤੁਸੀਂ ਦੱਸੋ ਸਭ ਠੀਕ ਹਾਂਜੀ ਬੈਠਾ ਤਾਂ ਹੁੰਦਾ ਹੈ ਕਿਉਂ ਕੁਛ ਹੋਇਆ ਮੈਂ ਤਾਂ ਦੇਖੋ ਹਜੇ ਕੱਲ੍ਹ ਹੀ ਪੁੱਛਿਆ ਹੈ ਉਹ ਕਹਿੰਦਾ ਨਹੀਂ ਮੈਂ ਮੇਰੇ ਤਾਂ ਬਹੁਤ ਵਧੀਆ ਨੰਬਰ ਆਉਂਦੇ ਪਏ ਐਂ ਚਲੋ ਮੈਂ ਤਾਂ ਕੁਝ ਦਿਨਾਂ ਤੋਂ ਨਾ ਜ਼ਿਆਦਾ ਹੀ ਬਿਜ਼ੀ ਸੀ ਇਸ ਲਈ ਮੈਂ ਇਹਦੇ 'ਤੇ ਧਿਆਨ ਨਹੀਂ ਦੇ ਪਾਈ ਹੁਣ ਮੈਂ ਧਿਆਨ ਦੇਵਾਂਗੀ ਹਾਂਜੀ ਓਕੇ ਹਾਂਜੀ ਹਾਂਜੀ ਜ਼ਰੂਰ ਅਗਰ ਤਾਂ ਇਹ ਆਪਣੀ ਸਟੱਡੀ ਨੂੰ ਲੈ ਕੇ ਅਗਰ ਸਹੀ ਨਹੀਂ ਹੈਗਾ ਘੱਟ ਮਾਰਕਸ ਆ ਰਹੇ ਆ ਤਾਂ ਕੋਈ ਗੱਲ ਨਹੀਂ ਤੁਸੀਂ ਕਰਵਾਓ ਭਾਵੇਂ ਘੰਟਾ ਕਿਉਂ ਨਾ ਲਵਾਓ ਪਰ ਇਹਦੇ ਮਾਰਕਸ ਵਧੀਆ ਆਉਣੇ ਚਾਹੀਦੇ ਹੈ ਨਹੀਂ ਠੀਕ ਹੈ ਧੰਨਵਾਦ